ਹਾਂਜੀ

ਹਾਂਜੀ ਹੋ ਸਕਦਾ ਹੈ ਮਤਲਬ ਇੱਕ ਲੱਖ ਤੱਕ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਵਧੀਆ ਹੋਊਗਾ ਜਦ ਦੇਖ ਲਓ ਤੁਸੀਂ ਜਦ ਫ਼ਰੀ ਹੋਊਗੇ ਜਿੱਥੇ ਤੁਹਾਨੂੰ ਠੀਕ ਲੱਗਦਾ ਮੈਂ ਤੁਹਾਨੂੰ ਐਡਰੱਸ ਵਗੈਰਾ ਸਭ ਕੁਛ ਸੈਡ ਸੈਂਡ ਕਰ ਦੇਣਾ ਹਾਂਜੀ ਹਾਂਜੀ ਹਾਂਜੀ ਸਭ ਕੁਛ ਵਧੀਆ ਹੁੰਦਾ ਅਰੇਜਮੈਂਟ ਵਗੈਰਾ ਸਾਰਾ ਕੁਛ ਤੁਹਾਨੂੰ ਵਧੀਆ ਮਿਲੂਗਾ ਕੋਆਲਟੀ ਵੀ ਵਧੀਆ ਇਹਦੀ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨੀ ਦੇਵਾਂਗੇ ਅਸੀਂ ਹਾਂਜੀ ਹਾਂਜੀ ਹਾਂਜੀ ਜ਼ਰੂਰ ਹਾਂਜੀ ਸਭ ਕੁਛ ਵਧੀਆ ਮਿਲੂਗਾ ਤੁਹਾਨੂੰ ਹਾਂਜੀ ਠੀਕ ਹੈ ਹਾਂਜੀ ਤੁਸੀਂ ਇੱਕ ਵਾਰੀ ਅਸੀਂ ਮਿਲਕੇ ਫਿਰ ਦੇਖਾਂਗੇ ਕਿਆ ਕਿਆ ਤੁਹਾਨੂੰ ਜਿੱਦਾਂ ਤੁਹਾਨੂੰ ਠੀਕ ਲੱਗਦਾ ਅਰੇਜਮੈਂਟ ਵਗੈਰਾ ਦਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਸਭ ਕੁਛ ਠੀਕ ਮਿਲੇਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਜੀ ਥੈਂਕ ਯੂ